ਰੂਪਨਗਰ ਵਿੱਚ ਜੇਕਰ ਮੰਨੋਰੰਜਕ ਗਤੀਵਿਧੀਆਂ ਨੂੰ ਦੇਖਿਆ ਜਾਵੇ ਤਾਂ ਜੋ ਮੁੱਖ ਰੂਪ ਵਿੱਚ ਸਾਹਮਣੇ ਆਉਂਦੀਆਂ ਹਨ ਉਹ ਕ੍ਰਿਕਟ ਫੁੱਟਬਾਲ ਕਬੱਡੀ ਅਤੇ ਵਾਲੀਬਾਲ ਹਨ ਇਸ ਤੋਂ ਇਲਾਵਾ ਬਲ਼ਦਾਂ ਦੀ ਦੌੜਾਂ ਵੀ ਪ੍ਰਚਲਿਤ ਹਨ ਇਹ ਦੌੜਾਂ ਅਲੱਗ ਅਲੱਗ ਪਿੰਡਾਂ ਵਿੱਚ ਕਰਵਾਈਆਂ ਜਾਂਦੀਆਂ ਹਨ ਇਸ ਦੇ ਨਾਲ ਭਾਈਚਾਰੇ ਦੇ ਪ੍ਰਫੁਲਿਤ ਹੋਣ ਵਿੱਚ ਕਾਫ਼ੀ ਯੋਗਦਾਨ ਹੁੰਦਾ ਹੈ ਕ੍ਰਿਕਟ ਵਾਲੀਬਾਲ ਅਤੇ ਫੁੱਟਬਾਲ ਦੇ ਟੂਰਨਾਮੈਂਟ ਵਿੱਚ ਨੌਜਵਾਨਾਂ ਦਾ ਸ਼ਿਰਕਤ ਸਭ ਤੋਂ ਜ਼ਿਆਦਾ ਹੁੰਦੀ ਹੈ